ਤੈਕਨੋਲਜੀ ਨੇ ਛੋਟੇ ਕਾਰੋਬਾਰਾਂ ਦੇ ਵਿਕਾਸ ਵਿੱਚ ਬਹੁਤ ਮਦਦ ਕੀਤੀ ਹੈ ਟੈਕਨੋਲੋਜੀ ਨੇ ਰੁਜ਼ਗਾਰ ਦੇ ਵਿੱਚ ਵਾਧਾ ਕੀਤਾ ਹੈ ਜਿਹਨਾ ਨਾਲ ਲੋਕਾਂ ਦੇ ਆਮਦਨ ਵਿੱਚ ਵਾਧਾ ਹੁੰਦਾ ਹੈ ਅੱਜ ਕੱਲ੍ਹ ਲੋਕ ਆਪਣਾ ਕਾਰੋਬਾਰ ਆਨਲਾਈਨ ਵੀ ਕਰਦੇ ਹਨ ਜਿਵੇਂ ਆਨਲਾਈਨ ਕੱਪੜੇ ਆਨਲਾਈਨ ਬੂਟ ਆਦਿ ਹਾਲੇ ਮੇਰੇ ਕੋਲ ਕੋਈ ਕਾਰੋਬਾਰ ਨਹੀਂ ਹੈ